ਜਿੱਦਾਂ ਕਿ ਆਪਾਂ ਅੱਜ ਦੇ ਸਮੇਂ ਵਿੱਚ ਦੇਖਦੇ ਹੀ ਹਾਂ ਕਿ ਹਰ ਇੱਕ ਬੰਦਾ ਜਿਹੜਾ ਹੈ ਉਹ ਹੈੱਡਫੋਨ ਦੀ ਬਹੁਤ ਹੀ ਜ਼ਿਆਦਾ ਵਰਤੋਂ ਕਰਦਾ ਹੈ ਹਰ ਇੱਕ ਕੋਲ ਜਿਹੜਾ ਵਾ ਉਹ ਆਪਣਾ ਆਪਣਾ ਅਲੱਗ ਅਲੱਗ ਹੈੱਡਫੋਨਸ ਹੁੰਦੇ ਹਾਂ ਹੁਣ ਕਈ ਵਾਰ ਅਗਰ ਆਪਾਂ ਬੱਸ 'ਚ ਸਫ਼ਰ ਕਰਦੇ ਹੋਏ ਮੈਂ ਦੇਖਿਆ ਕਿ ਕਈ ਵਾਰ ਜਦੋਂ ਵੀ ਕੋਈ ਸਟੂਡੈਂਟਸ ਜਾਂਦੇ ਆ ਜਾਂ ਫਿਰ ਕੋਈ ਵੀ ਆਮ ਤੌਰ 'ਤੇ ਕੋਈ ਵੀ ਬੰਦੇ ਜਾਂਦੇ ਆ ਜਦੋਂ ਉਹ ਬੱਸ ਵਿੱਚ ਫ੍ਰੀ ਹੁੰਦੇ ਆ ਤਾਂ ਉਹ ਕਿੰਨਾ ਕਿੰਨਾ ਟਾਈਮ ਜਿਹੜਾ ਵਾ ਉਹ ਹੈੱਡਫੋਨ ਲਗਾ ਕੇ ਜਿਹੜੇ ਉਹ ਬੈਠੇ ਰਹਿੰਦੇ ਆ ਕੁਝ ਵੀਡੀਓ ਦੇਖ ਰਹਿੰਦੇ ਆ ਕੁਝ ਜਿਹੜੇ ਆ ਸੌਂਗਸ ਸੁਣ ਲੈਂਦੇ ਆ ਅਤੇ ਉਹ ਇੰਨੀ ਜ਼ਿਆਦਾ ਆਵਾਜ਼ 'ਚ ਸੁਣਦੇ ਆ ਕਿ ਉਹਦੇ ਲਾਗੇ ਬੈਠੇ ਜਿੱਦਾਂ ਮੇਰੇ ਲਾਗੇ ਕੋਈ ਬੈਠਾ ਸੀਗਾ ਤਾਂ ਉਹ ਇੰਨੀ ਆਵਾਜ਼ ਉਹਨੇ ਕੀਤੀ ਹੋਈ ਸੀਗੀ ਕਿ ਮੈਨੂੰ ਹੈੱਡਫੋਨ ਤੋਂ ਬਾਹਰ ਵੀ ਸੁਣਦਾ ਪਿਆ ਸੀਗਾ ਕਿ ਉਹ ਕਿਹੜੇ ਸੌਂਗ ਸੁਣਦਾ ਪਿਆ ਜਾਂ ਕੀ ਕਰਦਾ ਪਿਆ ਮਤਲਬ ਕਿ ਉਹਨੇ ਇੰਨੀ ਜ਼ਿਆਦਾ ਆਵਾਜ਼ ਕੀਤੀ ਹੋਈ ਸੀਗੀ ਹੁਣ ਆਪਾਂ ਦੇਖਦੇ ਹਾਂ ਕਿ ਆਪਣੇ ਜਦੋਂ ਆਪਾਂ ਹੈੱਡਫੋਨ ਲਗਾਉਂਦੇ ਹਾਂ ਤਾਂ ਇੱਕ ਵੋਲਿਊਮ ਦੀ ਉਹ ਲਿਮਿਟ ਦਿੰਦੇ ਹਾਂ ਕਿ ਇਸ ਤੋਂ ਬਾਅਦ ਕਰਨ ਨਾਲ ਜਿਹੜਾ ਵਾ ਉਹ ਨੁਕਸਾਨ ਵੀ ਹੋ ਸਕਦਾ ਹੈ ਪਰ ਉਹ ਕੀ ਕਰਦੇ ਅੱਜ ਕੱਲ੍ਹ ਕੀ ਜ਼ਿਆਦਾ ਉਹਨਾਂ ਨੂੰ ਲੱਗਦਾ ਪਤਾ ਨਹੀਂ ਮਜ਼ਾ ਆਊ ਜਾਂ ਕੀ ਉਹ ਹੋਰ ਆਵਾਜ਼ ਕਰ ਲੈਂਦੇ ਹਾਂ ਅਤੇ ਫਿਰ ਉਹ ਆਵਾਜ਼ ਜਿਹੜੀ ਉਹਨਾਂ ਨੂੰ ਨੁਕਸਾਨ ਪਹੁੰਚਾਉਂਦੀ ਆ ਅਤੇ ਲਾਗੇ ਬੈਠੇ ਜੋ ਬੰਦਾ ਉਹਨੂੰ ਵੀ ਆਰਾਮ ਨਾਲ ਹੀ ਉਹ ਸਭ ਸੁਣਦਾ ਰਹਿੰਦਾ ਹੈ ਉਸ ਤੋਂ ਇਲਾਵਾ ਕਈ ਕੀ ਕਰਦੇ ਆ ਕਿ ਹੈੱਡਫੋਨ ਲਗਾ ਕੇ ਹੀ ਸੜਕ ਜਿਹੜੀ ਉਹ ਕਰੋਸ ਕਰਨ ਲੱਗਦੇ ਆ ਕੋਈ ਹੋਰਨ ਵਜਾ ਰਿਹਾ ਹੈ ਕੋਈ ਆਵਾਜ਼ ਲਗਾਉਂਦਾ ਪਿਆ ਹੈ ਉਹਨਾਂ ਨੂੰ ਕੁਝ ਵੀ ਨਹੀਂ ਸੁਣਦਾ ਅਤੇ ਇੱਦਾਂ ਕੀ ਕਰਦੇ ਆ ਉਹ ਆਪਣੇ ਆਪ ਦੀ ਜਿਹੜੀ ਜਾਨ ਦਾ ਰਿਸਕ ਜਿਹੜਾ ਉਹ ਆਪੇ ਲੈਂਦੇ ਆ ਇਸ ਤੋਂ ਇਲਾਵਾ ਜਿਹੜੇ ਜਿਨ੍ਹਾਂ ਕਰਕੇ ਮਤਲਬ ਉਹਨਾਂ ਦਾ ਜਿਵੇਂ ਐਕਸੀਡੈਂਟ ਮੰਨ ਲਓ ਹੋ ਜਾਂਦਾ ਹੈ ਇਸ ਤਰ੍ਹਾਂ ਉਹ ਆਵਾਜ਼ ਨਹੀਂ ਸੁਣਦੇ ਅਤੇ ਫਿਰ ਉਹ ਬਲੇਮ ਵੀ ਜਿਹੜਾ ਵਾ ਦੂਸਰੇ ਬੰਦੇ 'ਤੇ ਆ ਜਾਂਦਾ ਹੈ ਜਦੋਂ ਕਿ ਇਹ ਨਹੀਂ ਕੋਈ ਵੇਖਦਾ ਕਿ ਉਹਨੇ ਹੈੱਡਫੋਨ ਲਗਾਏ ਸੀ ਜਾਂ ਉਹਨੂੰ ਹੋਰਨ ਨਹੀਂ ਸੁਣਿਆ ਜਾਂ ਕੁਝ ਵੀ ਚੀਜ਼ ਮਤਲਬ ਕਿ ਉਹ ਆਪਣੇ ਸੜਕ ਉੱਤੇ ਚੱਲਦਿਆਂ ਹੈੱਡਫੋਨ ਦਾ ਯੂਜ਼ ਕਰਕੇ ਜਿਹੜਾ ਵਾ ਆਪਣੀ ਜਾਨ ਦਾ ਰਿਸਕ ਆਪ ਲੈਂਦੇ ਆ ਇਸ ਤੋਂ ਇਲਾਵਾ ਜ਼ਿਆਦਾ ਸਮੇਂ ਤੱਕ ਹੈੱਡਫੋਨ ਲਗਾਉਣ ਨਾਲ ਕੀ ਹੁੰਦਾ ਹੈ ਕਿ ਆਪਣੇ ਜਿਹੜੇ ਕੰਨ ਹੈਗੇ ਉਹਨਾਂ ਦੀ ਜਿਹੜੀ ਸੁਣਨ ਦੀ ਜਿਹੜੀ ਸ਼ਕਤੀ ਹੈਗੀ ਆ ਉਹ ਘਟਣੀ ਸ਼ੁਰੂ ਹੋ ਜਾਂਦੀ ਆ ਆਪਣਾ ਜਿਹੜਾ ਮਾਇੰਡ ਵਾ ਆਪਣਾ ਜਿਹੜਾ ਦਿਮਾਗ ਆ ਉਹ ਬੜਾ ਮਤਲਬ ਕਿ ਬੋਝ ਜਿਹੇ ਵਿੱਚ ਰਹਿੰਦਾ ਹੈ ਡਿਪਰੈੱਸ ਜਿਹਾ ਹੋ ਜਾਂਦਾ ਹੈ ਬੰਦਾ ਠੀਕ ਹੈ ਸਿਰ ਦੁੱਖਦਾ ਰਹਿੰਦਾ ਮਤਲਬ ਕਿ ਕਈ ਹੈਲਥ ਇਸ਼ੂਜ ਵੀ ਜਿਹੜੇ ਆ ਇਹਦੇ ਨਾਲ ਹੋ ਸਕਦੇ ਆ ਸੋ ਅੱਜ ਕੱਲ੍ਹ ਜਿਹੜੇ ਆ ਇਹ ਬਹੁਤ ਹੀ ਟਰੈਂਡ ਬਣ ਗਏ ਕਿ ਹਰ ਇੱਕ ਬੰਦਾ ਜਿਹੜਾ ਉਹ ਹੈੱਡਫੋਨ ਲਗਾਉਂਦਾ ਹੀ ਲਗਾਉਂਦਾ ਜ਼ਿਆਦਾ ਸਮੇਂ ਤੱਕ ਲਗਾਉਂਦਾ ਹੈ ਘੰਟਿਆਂ ਬੱਧੀ ਜਿਹੜੇ ਆ ਉਹ ਹੈੱਡਫੋਨ ਲਗਾ ਕੇ ਕੋਈ ਵੀ ਸੌਂਗ ਕੋਈ ਵੀ ਵੀਡੀਓ ਕੋਈ ਵੀ ਫਿਲਮ ਜਿਹੜੀ ਉਹ ਵੇਖਦੇ ਰਹਿੰਦੇ ਆ ਜਿਹਦੇ ਨਾਲ ਕੀ ਹੁੰਦਾ ਹੈ ਉਹਨਾਂ ਦਾ ਆਪਣਾ ਹੀ ਨੁਕਸਾਨ ਹੁੰਦਾ ਹੈ ਪਰ ਉਹ ਜਿਹੜੇ ਆ ਇਸ ਚੀਜ਼ ਨੂੰ ਪਤਾ ਹੁੰਦਿਆਂ ਵੀ ਜਿਹੜਾ ਹੈ ਉਹ ਉਹਨੂੰ ਨਜ਼ਰ ਅੰਦਾਜ਼ ਕਰਦੇ ਆ ਅਤੇ ਆਪਣੇ ਆਪ ਨਾਲ ਜਿਹੜਾ ਇੱਦਾਂ ਦੇ ਹੈਲਥ ਇਸ਼ੂਜ ਜਿਹੜੇ ਹੁੰਦੇ ਆ ਉਹਨਾਂ ਨੂੰ ਵੀ ਇੱਕ ਸੱਦਾ ਦਿੰਦੇ ਹਾਂ ਨਾਲ ਦੇ ਨਾਲ ਆਪਣੀ ਨਾਲ ਇਸ ਤਰ੍ਹਾਂ ਦੇ ਜਿਹੜੇ ਆ ਉਹ ਰਿਸਕ ਲੈਂਦੇ ਹਾਂ ਸੋ ਕਈ ਵਾਰ ਕੀ ਹੁੰਦਾ ਹੈ ਕਿ ਲਾਗੇ ਜਿਹੜਾ ਬੈਠਾ ਬੰਦਾ ਆਵਾਜ਼ ਲਗਾਉਂਦਾ ਰਹਿੰਦਾ ਹੈ ਦੱਸਦਾ ਰਹਿੰਦਾ ਕੁਝ ਬੋਲਦਾ ਹੈ ਤਾਂ ਉਹ ਜਿਹੜੇ ਆ ਉਹਨਾਂ ਦੀ ਗੱਲ ਨੂੰ ਵੀ ਇੱਕ ਟਾਈਮ ਨਜ਼ਰ ਅੰਦਾਜ਼ ਕਰਦੇ ਹਾਂ ਜਦੋਂ ਕਿ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹਨਾਂ ਨੂੰ ਥੋੜ੍ਹੀ ਆਵਾਜ਼ ਘੱਟ ਕਰ ਲੈਣੀ ਚਾਹੀਦੀ ਆ ਕੋਈ ਲਾਗੇ ਬੈਠਾ ਹੈ ਕੋਈ ਮਤਲਬ ਉਹ ਵੀ ਡਿਸਟਰਬ ਹੁੰਦਾ ਪਿਆ ਹੈ ਉਹਨਾਂ ਨੂੰ ਇਸ ਚੀਜ਼ ਨਾਲ ਹੁਣ ਕੋਈ ਮਤਲਬ ਨਹੀਂ ਗਾ ਉਹ ਜ਼ਿਆਦਾ ਜਿਹੜੇ ਆ ਹੈੱਡਫੋਨ ਦਾ ਯੂਜ਼ ਕਰਨ ਵਿੱਚ ਹੀ ਅੱਜ ਕੱਲ੍ਹ ਸਾਰੇ ਜਿਹੜੇ ਆ ਉਹ ਲੱਗੇ ਹੋਏ ਆ